ਜਿਵੇਂ ਕਿ ਪਹਿਲਾਂ ਬੱਚੇ ਗੋਲਕਾਂ ਵਿੱਚ ਪੈਸਾ ਜਮ੍ਹਾਂ ਕਰਦੇ ਸਨ ਓਵੇਂ ਹੀ ਅੱਜ ਦੇ ਸਮੇਂ ਵਿੱਚ ਬੈਂਕ ਜੋ ਹੈ ਉਹ ਬਹੁਤ ਹੀ ਚੰਗਾ ਵਿਕਲਪ ਹੈ ਜਿਸ ਵਿੱਚ ਉਹ ਆਪ ਜਾ ਕੇ ਇੱਕ ਖਾਤਾ ਖੁਲਵਾ ਸਕਦੇ ਹਨ ਅਤੇ ਆਪਣਾ ਸਾਰਾ ਪੈਸਾ ਉੱਥੇ ਜਮ੍ਹਾਂ ਕਰਵਾ ਸਕਦੇ ਹਨ ਇਸ ਲਈ ਬੱਚਿਆਂ ਨੂੰ ਉਤਸ਼ਾਹਿਤ ਅਤੇ ਪ੍ਰੇਰਿਤ ਕਰਨਾ ਬਹੁਤ ਜ਼ਰੂਰੀ ਹੈ ਤਾਂ ਕਿ ਉਨ੍ਹਾਂ ਨੂੰ ਬੈਂਕਾਂ ਬਾਰੇ ਵੀ ਜਾਣਕਾਰੀ ਮਿਲ ਸਕੇ ਅਤੇ ਛੋਟੀ ਉਮਰ ਤੋਂ ਹੀ ਉਹ ਬੈਂਕਾ ਦੇ ਨਿਯਮਾਂ ਅਤੇ ਉੱਥੇ ਜਾ ਕੇ ਕਿਵੇਂ ਪੈਸਿਆਂ ਦੀ ਸਾਂਭ ਸੰਭਾਲ ਕਰ ਸਕਦੇ ਹਨ ਕਿਵੇਂ ਅਸੀਂ ਪੈਸੇ ਜਮ੍ਹਾਂ ਕਰਵਾ ਕੇ ਅੱਗੇ ਉਸ ਦਾ ਫਾਇਦਾ ਕਿਵੇਂ ਸਾਨੂੰ ਮਿਲ ਸਕਦਾ ਹੈ ਇਸ ਬਾਰੇ ਜਾਣਕਾਰੀ ਲੈ ਸਕਣ ਅਤੇ ਇਸ ਦੇ ਨਾਲ ਹੀ ਜਦੋਂ ਉਹ ਬੈਂਕ ਵਿੱਚ ਪੈਸੇ ਜਮ੍ਹਾਂ ਕਰਾਉਂਦੇ ਹਨ ਪੈਸਿਆਂ ਦੀ ਉਨ੍ਹਾਂ ਨੂੰ ਕੀਮਤਾਂ ਪਤਾ ਲੱਗਦੀਆਂ ਹਨ ਅਤੇ ਅੱਗੇ ਦੀ ਜ਼ਿੰਦਗੀ ਵਿੱਚ ਉਹ ਪੈਸਿਆਂ ਨੂੰ ਕਿਵੇਂ ਕਿਸ ਤਰੀਕੇ ਨਾਲ ਅੱਗੇ ਕੰਮਾਂ ਵਿੱਚ ਇਸਤੇਮਾਲ ਕਰ ਸਕਦੇ ਹਨ ਉਸ ਦੇ ਬਾਰੇ ਵੀ ਉਨ੍ਹਾਂ ਨੂੰ ਜਾਣ ਉਹ ਜਾਣੂ ਹੁੰਦੇ ਹਨ ਕਿਉਂਕਿ ਅੱਜ ਦੇ ਸਮੇਂ ਵਿੱਚ ਪੈਸਿਆਂ ਦੀ ਸਾਂਭ ਸੰਭਾਲ ਬਹੁਤ ਜ਼ਰੂਰੀ ਹੈ ਅਤੇ ਉੱਨਾਂ ਹੀ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਕਿਸ ਜਗ੍ਹਾ ਅਤੇ ਕਿਸ ਤਰੀਕੇ ਨਾਲ ਇਸਤੇਮਾਲ ਕਰਨਾ ਹੈ ਜੇ ਬੱਚਿਆਂ ਨੂੰ ਬਹੁਤ ਹੀ ਘੱਟ ਉਮਰ ਵਿੱਚ ਇਨ੍ਹਾਂ ਚੀਜ਼ਾਂ ਦੀ ਜਾਣਕਾਰੀ ਮਿਲ ਜਾਵੇ ਤਾਂ ਉਹ ਆਪਣੇ ਪੈਸਿਆਂ ਨੂੰ ਬਹੁਤ ਸਹੀ ਤਰੀਕੇ ਨਾਲ ਇਸਤੇਮਾਲ ਕਰ ਸਕਦੇ ਹਨ ਅਤੇ ਬੈਂਕਾਂ ਦੇ ਬਹੁਤ ਸਾਰੇ ਜੋ ਲ ਲਾਭ ਹਨ ਉਨ੍ਹਾਂ ਬਾਰੇ ਵੀ ਜਾਗਰੂਕ ਹੋ ਸਕਦੇ ਹਨ